ਕਾਰਬਨ ਫੁੱਟ ਪ੍ਰਿਨ ਨੂੰ ਘਟਾਉਣਾ ਬਹੁਤ ਹੀ ਜ਼ਰੂਰੀ ਹੋ ਚੁੱਕਾ ਹੈ ਅੱਜ ਦੇ ਸਮੇਂ ਦੀ ਮੰਗ ਹੈ ਕਿ ਕਾਰਬਨ ਦੀਆਂ ਜੋ ਗੈਸਾਂ ਚੱਲ ਰਹੀਆਂ ਹੈ ਉਹਨਾਂ ਨੂੰ ਵਾਤਾਵਰਨ ਦੇ ਉੱਤੇ ਜੋ ਉਹਨਾਂ ਨੇ ਬੁਰਾ ਅਸਰ ਪਾਇਆ ਹੈ ਜੋ ਕਿ ਅਸੀਂ ਅੱਜ ਦੇ ਮੌਸਮ ਦੇ ਵਿੱਚ ਆਰਾਮ ਨਾਲ ਵੇਖ ਵੀ ਸਕਦੇ ਹਾਂ ਉਹਨੂੰ ਬਹੁਤ ਘਟਾਉਣਾ ਚਾਹੀਦਾ ਹੈ ਸਾਨੂੰ ਸ਼ੁਰੂਆਤ ਬਾਹਰ ਤੋਂ ਨਹੀਂ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ ਘੱਟ ਤੋਂ ਘੱਟ ਉਹ ਚੀਜ਼ਾਂ ਇਸਤੇਮਾਲ ਕਰੀਏ ਜੋ ਬਿਜਲੀ ਦੇ ਖਪਤ ਕਰਦੀਆਂ ਹਨ ਉਸ ਤੋਂ ਬਾਅਦ ਸੋਲਰ ਲਗਾਓ ਆਪਣੇ ਘਰ ਵਿੱਚ ਬਹੁਤ ਸੌਖਾ ਤਰੀਕਾ ਹੈ ਬੱਤੀ ਸੋਲਰ ਵਾਲੀ ਇਸਤੇਮਾਲ ਕਰੋ ਪਲਾਸਟਿਕ ਵਾਲੀਆਂ ਚੀਜ਼ਾਂ ਜੋ ਘਰ ਦੇ ਵਿੱਚ ਬਹੁਤ ਜ਼ਿਆਦਾ ਅਤੇ ਸਪੈ ਖਾਸ ਕਰਕੇ ਵਾਤਾਵਰਨ ਨੂੰ ਖਰਾਬ ਕਰਦੀਆਂ ਹਨ ਉਹਨਾਂ ਦਾ ਘੱਟ ਤੋਂ ਘੱਟ ਇਸਤੇਮਾਲ ਕੀਤਾ ਜਾਏ ਇਹਨਾਂ ਦੇ ਨਾਲ ਸਾਡੇ ਦੇਸ਼ ਦੇ ਵਿੱਚ ਹੋ ਰਹੇ ਕਾਰਬਨ ਮਿਸ਼ਨ ਕਾਰਬਨ ਫੁੱਟ ਪ੍ਰਿੰਟ ਜਾਂ ਐਨਰਜੀ ਕੁਸ਼ਲ ਭਾਰਤ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ